ਅੱਜ ਤੋਂ ਨਾ ਮੈਂ ਪਹਿਲਾਂ ਵੀਹ ਦਿਨ ਫਲਿਪਕਾਟ ਤੋਂ ਉ ਜੈਕਟ ਆਪਣਾ ਕੀਤੀ ਸੀ ਜੀ ਔਡਰ ਉਹ ਮੈਨੂੰ ਆਪਣਾ ਮਿਲੀ ਹੈ ਅਤੇ ਉਹਦੀ ਪੈਕਿੰਗ ਬਾਹਰ ਤੋਂ ਬਹੁਤ ਵਧੀਆ ਬਣੀ ਹੋਈ ਸੀ ਜਦੋਂ ਮੈਂ ਉਹਦੀ ਪੈਕਿੰਗ ਆਪਣਾ ਖੋਲੀ ਤਾਂ ਪੈਕਿੰਗ ਖੋਲਦਿਆਂ ਸਾਰ ਹੀ ਮੈਨੂੰ ਬਹੁਤ ਵਧੀਆ ਆਪਣਾ ਲੱਗੀ ਉਹ ਜੈਕਟ ਇੱਕ ਤਾਂ ਆਪਣਾ ਗਰਮ ਸੀ ਇੱਕ ਆਪਣਾ ਕੰਪਨੀ ਦੀ ਸੀ ਉਹ ਨਾਈਕ ਆਪਣਾ ਕੰਪਨੀ ਦੀ ਸੀ ਆਪਣਾ ਵੀ ਜੈਕਟ ਅਤੇ ਜੈਕਟ ਦੇ ਬਟਨ ਆਪਣਾ ਜੇਬਾਂ ਜੂਬਾਂ ਬਹੁਤ ਵਧੀਆ ਸਨ ਉਹਦੀਆਂ ਕਮਾਲ ਦੀਆਂ ਅਤੇ ਇੱਕ ਜਿਹੜਾ ਉਹਦਾ ਕੱਪੜਾ ਸੀ ਕੱਪੜਾ ਬਹੁਤ ਮ ਅੱਛਾ ਵੀ ਵਧੀਆ ਸੀ ਅੰਦਰ ਵੀ ਯਾਨੀ ਕਿ ਬਾਹਰ ਵੀ ਉਹਨੂੰ ਪਾ ਕੇ ਆਪਾਂ ਜਿਵੇਂ ਠੰਡ ਦੇ ਵਿੱਚ ਮ ਕਿ ਜਾਂਦੇ ਹਾਂ ਯਾਨੀ ਕਿ ਉਹਦੇ ਹਵਾ ਨਹੀਂ ਹੁੰਦੀ ਆਰ ਪਾਰ ਅਤੇ ਉਹ ਫਿਰ ਮੈਂ ਜੈਕਟ ਬਾਰੇ ਵੀ ਆਪਣੇ ਯਾਰਾਂ ਨਾਲ ਆਪਣਾ ਗੱਲ ਕਰੀ ਵੀ ਇੱਦਾਂ ਇੱਦਾਂ ਮੈਂ ਫਲਿਪਕਾਟ ਕੰਪਨੀ ਤੋਂ ਜੈਕਟ ਕਰੀ ਸੀ ਔਡਰ ਵੀ ਜੈਕਟ ਬਹੁਤ ਵਧੀਆ ਜਦੋਂ ਉਹਨਾਂ ਨੇ ਇਹ ਜੈਕਟ ਬਾਰੇ ਆਪਣਾ ਸੁਣਿਆ ਆਪਣਾ ਦੇਖਿਆ ਉਹਨਾਂ ਨੇ ਵੀ ਨਾਲ ਦੀ ਨਾਲ ਇਹ ਅੱਛਾ ਇਹਦੇ 'ਤੇ ਫਲਿਪਕਾਟ 'ਤੇ ਆਪਣਾ ਇਹ ਕਰਤਾ ਬੁੱਕ ਆਪਣਾ ਕਰਤਾ ਅਤੇ ਉਸ ਤੋਂ ਬਾਅਦ ਫਿਰ ਉਹ ਆਪਣਾ ਉਂਝ ਜੈਕਟ ਮੈਂ ਨਾ ਰਿਸ਼ਤੇਦਾਰੀ 'ਚ ਪਾ ਕੇ ਚਲੇ ਆਪਣੇ ਗਿਆ ਅਤੇ ਅੱਛਾ ਵ ਉਹਨਾਂ ਨੇ ਵੀ ਅੱਛਾ ਯਾਨੀ ਕਿ ਅੱਛਾ ਅੱਛਾ ਇਹਦੀ ਇੰਨੀ ਆਪਣਾ ਤਾਰੀਫ ਆਪਣਾ ਕਰੀ ਕਿ ਬਹੁਤ ਆਪਣਾ ਕਰੀ ਅਤੇ ਮੈਨੂੰ ਵੀ ਵਧੀਆ ਆਪਣਾ ਅੱਛਾ ਲੱਗੀ ਅੱਗੇ ਤੋਂ ਵੀ ਮੈਂ ਫਲਿਪਕਾਡ ਤੋਂ ਸਮਾਨ ਆਪਣਾ ਕਰਾਂਗਾ ਜੀ ਵੱਧ ਤੋਂ ਵੱਧ ਅਤੇ ਬੁੱਕ ਵੈਸੇ ਮੈਨੂੰ ਅੱਛਾ ਇਹਨਾਂ ਦਾ ਬਹੁਤ ਆਪਣਾ ਧੰਨਵਾਦ ਹੈ ਕਿ ਕਿਉਂਕਿ ਮੈਨੂੰ ਅੱਗੇ ਸਿਆਲ ਸੀ ਆ ਰਿਹਾ ਸਿਆਲ ਕਰਕੇ ਮੈਂ ਫਲਿਪਕਾਟ ਤੋਂ ਕਰੀ ਸੀ ਆਪਣਾ ਆਪਣੀ ਇਹ ਜੈਕਟ ਅਤੇ ਵੀ ਔਡਰ ਮੈਨੂੰ ਵਧੀਆ ਆਪਣਾ ਲੱਗੀ ਜੀ